ਜਦੋਂ ਵੀ ਅਸੀਂ ਸਾਈਕਲ ਚਲਾਉਣਾ ਹੋਵੇ ਸਭ ਤੋਂ ਪਹਿਲਾਂ ਉਸਦੇ ਟਾਇਰਾਂ ਵਿੱਚ ਹਵਾ ਚੈੱਕ ਕਰੋ ਉਸ ਤੋਂ ਬਾਅਦ ਉਸਦੇ ਬਰੇਕ ਚੈੱਕ ਕਰੋ ਫਿਰ ਹੀ ਸਾਈਕਲ ਨੂੰ ਤੋਰੋ ਜਦੋਂ ਘਰੋਂ ਨਿਕਲਦੇ ਹੋ ਜਾਂ ਮੇਨ ਸੜਕ 'ਤੇ ਚੜ੍ਹਨਾ ਹੋਵੇ ਤਾਂ ਦੋਨਾਂ ਪਾਸੇ ਦੇਖ ਕੇ ਹੀ ਸੜਕ 'ਤੇ ਚੜ੍ਹੋ ਕਈ ਵਾਰ ਕੋਈ ਤੇਜ਼ ਰਫਤਾਰ ਵਾਹਨ ਆ ਰਿਹਾ ਹੁੰਦਾ ਹੈ ਉਸ ਤੋਂ ਬਚਣ ਲਈ ਦੋਨੋਂ ਸਾਈਡ 'ਤੇ ਦੇਖਣਾ ਪੈਂਦਾ ਹੈ ਸੜਕ 'ਤੇ ਜਾਂਦੇ ਸਮੇਂ ਸਾਈਕਲ ਆਪਣੀ ਸਾਈਡ 'ਤੇ ਹੀ ਰੱਖੋ ਜਦੋਂ ਕਿਸੇ ਪਾਸੇ ਮੁੜਨਾ ਹੋਵੇ ਤਾਂ ਹੱਥ ਨਾਲ ਇਸ਼ਾਰਾ ਕਰੋ ਇਸ ਤਰ੍ਹਾਂ ਜੇ ਕੋਈ ਵਾਹਨ ਆ ਰਿਹਾ ਹੋਵੇ ਤਾਂ ਉਸਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਕਿਸ ਸਾਈਡ ਮੁੜਨਾ ਹੈ ਬਾਕੀ ਸਾਈਕਲ ਚਲਾਉਣ ਲਈ ਸਾਨੂੰ ਕਿਸੇ ਦਸਤਾਵੇਜ਼ ਦੀ ਜ਼ਰੂਰਤ ਨਹੀਂ ਪੈਂਦੀ ਖਾਸ ਕਰਕੇ ਭਾਰਤ ਵਰਗੇ ਦੇਸ਼ ਵਿੱਚ ਜੇ ਤੁਸੀਂ ਸਾਈਕਲ ਪਹਾੜੀ ਇਲਾਕੇ ਵਿੱਚ ਚਲਾ ਰਹੇ ਹੋ ਤਾਂ ਤੁਹਾਡੇ ਹੈਲਮਟ ਪਹਿਨਿਆ ਹੋਣਾ ਚਾਹੀਦਾ ਹੈ ਕਿਉਂਕਿ ਪਹਾੜੀ ਇਲਾਕਿਆਂ ਵਿੱਚ ਰਸਤਿਆਂ ਵਿੱਚ ਬਹੁਤ ਉਬੜ ਖਾਬੜ ਹੁੰਦੀ ਹੈ ਤਾਂ ਇਸ ਨਾਲ ਕਈ ਵਾਰ ਸੱਟ ਲੱਗਣ ਦਾ ਡਰ ਰਹਿੰਦਾ ਹੈ